ਹਾਂਜੀ ਸ਼ੌਂਕ ਇੱਕ ਬਹੁਤ ਹੀ ਖੂਬਸੂਰਤ ਜਿਹਾ ਵਰਡ ਹੈ ਤੁਹਾਨੂੰ ਵੀ ਪਤਾ ਹੈ ਕਿ ਜਦੋਂ ਹਰ ਇੱਕ ਬੰਦੇ ਨੂੰ ਸ਼ੌਂਕ ਹੁੰਦਾ ਕਿਸੇ ਨੂੰ ਰਹਿਣ ਸਹਿਣ ਦਾ ਕਿਸੇ ਨੂੰ ਖਾਣ ਪੀਣ ਦਾ ਇਸ ਤਰ੍ਹਾਂ ਮੈਨੂੰ ਹੀ ਫੋਟੋਗ੍ਰਾਫੀ ਦਾ ਬਹੁਤ ਹੀ ਸ਼ੌਕ ਐ ਮੈਂ ਜਿੱਥੇ ਵੀ ਜਾਂਦੀ ਹਾਂ ਬਹੁਤ ਚਾਰੀ ਸਾਰੀਆਂ ਫੋਟੋ ਲੈਂਦੀ ਹਾਂ ਔਰ ਉਹ ਫੋਟੋਆਂ ਮੈਂ ਹਰ ਟਾਈਮ ਆਪਣੇ ਕੋਲ ਆਪਣੇ ਨਾਲ ਸੰਭਾਲ ਕੇ ਰੱਖਦੀ ਹਾਂ ਸੋ ਮੈਨੂੰ ਸ਼ੁਰੂ ਤੋਂ ਹੀ ਬਚਪਨ ਤੋਂ ਲੈ ਕੇ ਅੱਜ ਤੱਕ ਸ਼ੋ ਫੋਟੋਸ ਨਾਲ ਬਹੁਤ ਜ਼ਿਆਦਾ ਲਗਾਅ ਰਿਹਾ ਤਾਂ ਮੇਰਾ ਇੱਕ ਹੋਬੀ ਹੈ ਮੇਰੀ ਇੱਕ ਉਹ ਜ਼ਿੰਦਗੀ ਦਾ ਇੱਕ ਬਹੁਤ ਹੀ ਮੇਨ ਪਾਰਟ ਹੈ ਜ ਔਰ ਮੈਨੂੰ ਫੋਟੋਸ ਲੈਣੀਆ ਬਹੁਤ ਹੀ ਪਸੰਦ ਹਨ